ਤੇਈ ਅਗਸਤ ਦੋ ਹਜ਼ਾਰ ਤਿੰਨ ਇੱਕ ਅਕਤੂਬਰ ਦੋ ਹਜ਼ਾਰ ਇੱਕ ਅਠਾਈ ਜੁਲਾਈ ਉੱਨੀ ਸੌ ਛਿਆਨਵੇਂ ਪੰਦਰਾਂ ਸਤੰਬਰ ਉੱਨੀ ਸੌ ਪੰਝੱਤਰ ਸੱਤ ਜੁਲਾਈ ਦੋ ਹਜ਼ਾਰ ਸੱਤ